ਪੰਜਾਬੀ ਗਾਇਕੀ ਦੇ ਵਿੱਚ ਕਾਫ਼ੀ ਕਾਫ਼ੀ ਸਮਾਂ ਪਹਿਲਾਂ ਇੱਕ ਮੈਂ ਤਲ ਤਲਵੰਡੀ ਸਾਬੋ ਇੱਕ ਫੰਕਸ਼ਨ 'ਤੇ ਗੀਤ ਗਾਇਆ ਸੀ ਸੋ ਅਤੇ ਉੱਥੇ ਕਾਫ਼ੀ ਰਸ਼ ਕਾਫ਼ੀ ਇਕੱਠ ਸੀਗਾ ਲੋਕਾਂ ਦਾ ਅਤੇ ਕਾਫ਼ੀ ਰਸ ਸੀਗਾ ਉੱਥੇ ਮੈਂ ਕੁਲਦੀਪ ਮਾਣਕ ਸਾਹਿਬ ਦਾ ਗੀਤ ਗਾਇਆ ਸੀ ਮਾਂ ਹੁੰਦੀ ਏ ਮਾਂ ਅਤੇ ਕਾਫ਼ੀ ਚੁਣੌਤੀ ਭਰਿਆ ਇੱਕ ਮਾਹੌਲ ਸੀ ਮੇਰੇ ਲਈ ਉਹ ਅਤੇ ਖੈਰ ਇੱਦੋਂ ਪਹਿਲਾਂ ਵੀ ਮੈਂ ਕਾਫ਼ੀ ਵਾਰ ਗਾ ਚੁੱਕਿਆ ਸੀਗਾ ਸੋ ਅਤੇ ਪਰ ਉਸ ਦੌਰ ਦੇ ਵਿੱਚ ਇੱਕ ਇਹ ਸੀ ਕਿ ਰਸ਼ ਕਾਫ਼ੀ ਵੱਡਾ ਸੀ ਅਤੇ ਕਾਫ਼ੀ ਜ਼ਿਆਦਾ ਨਰਵਸ ਹੋ ਗਿਆ ਸੀ ਮੈਂ ਅਤੇ ਫੇ ਪਰ ਫਿਰ ਵੀ ਮੈਂ ਗੀਤ ਪੂਰਾ ਕਰ ਦਿੱਤਾ ਸੀ ਅਤੇ ਉਹ ਮੈਨੂੰ ਇਹ ਕਾਫ਼ੀ ਚੁਣੌਤੀ ਭਰਿਆ ਮ ਇੱਕ ਸਮਾਂ ਸੀਗਾ ਸੋ ਬਾਕੀ ਬਾਕੀ ਮੈਨੂੰ ਹੋ ਮੇਰੀ ਮੇਰੀ ਜ਼ਿੰਦਗੀ ਦੇ ਵਿੱਚ ਖੈਰ ਉਹ ਇੱਕ ਉਹ ਹੀ ਸਮਾਂ ਸੀ ਜੋ ਚੁਣੌਤੀ ਭਰਿਆ ਲੱਗਿਆ ਮੈਨੂੰ ਅਤੇ ਬਾਕੀ ਹੋਰ ਫਿਰ ਕਦੇ ਨਰਵਸ ਨਹੀਂ ਹੋਇਆ